ਉਚਾਈ ਤੋਂ ਡਰ ਤਾਂ ਮੇਰੀ ਪੂਰੀ ਜ਼ਿੰਦਗੀ ਵਿੱਚ ਹੀ ਰਿਹਾ ਹੈ ਮੈਂ ਜਦੋਂ ਜਦੋਂ ਆਪਣੇ ਕੋਠੇ 'ਤੇ ਵੀ ਚੜ੍ਹਾਂ ਤਾਂ ਮੈਨੂੰ ਹਮੇਸ਼ਾਂ ਉਹ ਤੋਂ ਡਰ ਲੱਗਦਾ ਹੈ ਤਾਂ ਕਲਾਈਮਿੰਗ ਤਾਂ ਬਹੁਤ ਹੀ ਦੂਰ ਦੀ ਗੱਲ ਸੀ ਪਰ ਇਹ ਮੈਂ ਹਮੇ ਇੱਕ ਵਾਰ ਗਿਆ ਸੀ ਪਹਾੜਾਂ 'ਤੇ ਕਲਾਈਮਿੰਗ ਕਰਨ ਤਾਂ ਮੇਰੇ ਰੋਂਗਟੇ ਖੜਨ ਖੜ੍ਹੇ ਹੋ ਗਏ ਸੀ ਜਦੋਂ ਮੈਂ ਓ ਉਸ ਦੀ ਉਚਾਈ ਦੇਖੀ ਮੇਰੇ ਹੱਥਾਂ 'ਚ ਪਸੀਨਾ ਹੀ ਪਸੀਨਾ ਹੋ ਗਿਆ ਪਰ ਫਿਰ ਉਹ 'ਤੇ ਮੈਂ ਹੋਰ ਵੀ ਬੜੀ ਸੀਖ ਲਈ ਮੈਨੂੰ ਉੱਥੇ ਮੇਰੇ ਯਾਰਾਂ ਨੇ ਮੇਰੇ ਘਰਦਿਆਂ ਨੇ ਬੜਾ ਸਮਝਾਇਆ ਕਿ ਇੱਕ ਨਾ ਇੱਕ ਦਿਨ ਤੈਨੂੰ ਆਹ ਫੋਬੀਆ ਨੂੰ ਦੂਰ ਹੀ ਕਰਨਾ ਹੀ ਪਵੇਗਾ ਅਤੇ ਫਿਰ ਮੈਂ ਉਦੋਂ ਠਾਣ ਲਈ ਅਤੇ ਮੈਂ ਉਦੋਂ ਉੱਥੇ ਬੜੀ ਜ਼ਿਆਦਾ ਮਿਹਨਤ ਕੀਤੀ ਬੜੀ ਜ਼ਿਆਦਾ ਟ੍ਰੇਨਿੰਗ ਕੀਤੀ ਜਿਹਦੇ ਕਾਰਨ ਮੈਂ ਉਹ ਫੋਬੀਆ ਨੂੰ ਦੂਰ ਕਰਨ ਵਿੱਚ ਕਾਫੀ ਹੱਦ ਤੱਕ ਥੋੜ੍ਹਾ ਐਕਸਪਰਟ ਬਣ ਗਿਆ ਫਿਰ ਮੈਂ ਉ ਉਸ ਜਗ੍ਹਾ 'ਤੇ ਪਹਿਲੀ ਵਾਰ ਪਹਿਲੀ ਵਾਰ ਮੈਂ ਉੱਥੇ ਇਹ ਕਲਾਈਮਿੰਗ ਕੀਤੀ ਉਹ ਵੀ ਬੜੀ ਜ਼ਿਆਦਾ ਉੱਚੀ ਚੜ੍ਹਾਈ ਸੀ ਜਿਹਦੇ ਕਾਰਨ ਮੈਂ ਕਾਫੀ ਖੁਸ਼ ਵੀ ਰਿਹਾ ਅਤੇ ਮੇਰਾ ਫੋਬੀਆ ਦੂਰ ਹੋ ਗਿਆ ਉੱਥੇ ਲਾਸਟ ਟਾਈਮ ਉਹ ਇੱਕ ਹੀ ਜਗ੍ਹਾ ਸੀ ਜਿਹੜੀ ਮੈਨੂੰ ਬੜੀ ਜ਼ਿਆਦਾ ਪਸੰਦ ਜਗ੍ਹਾ ਆਈ ਕਿਉਂਕਿ ਉਹੀ ਜਗ੍ਹਾ 'ਤੇ ਮੈਂ ਆਪਣੇ ਫੋਬੀਆ ਨੂੰ ਦੂਰ ਕੀਤਾ